ਹੈਲੋ ਹਾਂਜੀ ਸਰ ਤੁਸੀਂ ਆਟੋ ਤੋਂ ਬੋਲਦੇ ਆਟੋ ਵਾਲੇ ਆ ਨਾ ਮੈਨੂੰ ਨੰਬਰ ਦਿੱਤਾ ਸੀ ਤੁਹਾਡਾ ਕਿਸੇ ਮੇਰੇ ਦੋਸਤ ਨੇ ਤੇ ਅਸੀਂ ਸਰ ਅੱਜ ਨਾ ਥੋੜਾ ਜਿਆ ਸ਼ਹਿਰ ਤੋਂ ਬਾਹਰ ਜਾਣਾ ਐ ਅਸੀਂ ਮੰਨ ਲੋ ਆਪਣੇ ਮੇਨ ਚੌਂਕ ਤੋਂ ਚੜ੍ਹਾਂਗੇ ਜਿਹੜਾ ਆਪਣਾ ਬੱਤੀ ਵਾਲਾ ਚੌਂਕ ਐ ਨਾ ਸੰਜੀਵ ਥੇਟਰ ਸੰਜੀਵ ਹਾਂ ਲਾਈਟਾਂ ਵਾਲਾ ਚੌਂਕ ਸੰਜੀਵ ਥੇਟਰ ਤੋਂ ਉੱਥੇ ਅਸੀਂ ਪੰਜ ਜਣੇ ਹੋਵਾਂਗੇ ਫਾਈਵ ਤੇ ਅਸੀਂ ਜਾਣਾ ਵਾਨਲਾ ਵਾਨਲਾ ਓਥੇ ਨਾ ਸ਼ਹਿਰ ਦੇ ਵਿੱਚੋਂ ਉਹ ਹੋਊਗਾ ਮੇਰੇ ਸਾਬ ਨਾਲ ਜੀ ਹਾਂ ਸੱਤ ਕ ਕਿਲੋਮੀਟਰ ਹੋਊਗਾ ਇੱਕ ਸਾਈਡ ਤੁਹਾਡਾ ਚੌਦਾਂ ਪੰਦਰਾਂ ਕਿਲੋਮੀਟਰ ਅੱਪ ਡਾਊਨ ਤੇ ਉਨ੍ਹਾਂ ਟਾਈਮ ਓਥੇ ਰੁੱਕਣਾ ਪੈਣਾ ਮਤਲਬ ਓਥੇ ਟਾਈਮ ਲੱਗ ਸਕਦਾ ਕੋਈ ਪੰਦਰਾਂ ਤੋਂ ਲੈ ਕੇ ਅੱਧਾ ਘੰਟਾ ਤੱਕ ਲੱਗ ਸਕਦਾ ਪੰਦਰਾਂ ਮਿੰਟ ਤੋਂ ਲੈ ਕੇ ਅੱਧਾ ਘੰਟਾ ਤੱਕ ਕਿਉਂਕੀ ਸਾਨੂੰ ਓਥੇ ਨਾ ਕਿਸੇ ਨਾਲ ਕੰਮ ਐ ਅਗਲਾ ਵੈਸੇ ਤਾਂ ਅਸੀਂ ਫੋਨ ਕਰਕੇ ਈ ਚੱਲੇ ਆਂ ਉਹਨੂੰ ਪਰ ਫੇਰ ਵੀ ਲਗਾ ਐਧਰ ਓਧਰ ਗਿਆ ਹੁੰਦਾ ਨਾ ਕਿਸੇ ਕੰਮ ਕਾਰ ਗਿਆ ਹੁੰਦਾ ਤਾਂ ਉੱਥੇ ਥੋਨੂੰ ਰੁੱਕਣਾ ਈ ਪਏਗਾ ਸਾਨੂੰ ਵਾਪਸ ਲੈ ਕੇ ਆਉਣਾ ਪਏਗਾ ਤੇ ਇਸ ਰਿਗਾਡਿੰਗ ਜੋ ਸੀ ਜਿਹੜਾ ਨਾ ਦੱਸੋ ਮੈਨੂੰ ਵੀ ਤੁਸੀਂ ਚੱਲ ਸਕਦੇ ਓ ਨਾ ਅੱਜ ਪੰਜਾਹ ਰੁਪਈਏ ਇੱਕ ਬੰਦੇ ਦੀ ਕੇ ਸਾਰਿਆਂ ਦੀ ਅੱਛਾ ਪੰਜਾਹ ਢਾਈ ਸੌ ਰੁਪਈਆ ਇੱਕ ਦੋਨੋਂ ਸਾਈਡ ਦਾ ਨਾ ਇੱਕ ਸਾਈਡ ਤੁਸੀਂ ਪੰਜਾਹ ਲਾਉਂਗੇ ਤੇ ਫੇਰ ਵਾਪਸੀ ਦੇ ਫੇਰ ਪੰਜਾਹ ਲਵੋਂਗੇ ਨਹੀਂ ਸਰ ਜਿਆਦਾ ਜੀ ਇਹ ਜਿਆਦਾ ਦੇਖੋ ਸੱਤ ਕਿਲੋਮੀਟਰ ਐ ਦਸ ਕ ਰੁਪਏ ਪਹਿਲਾਂ ਤਾਂ ਚੱਲਦੇ ਹੁੰਦੇ ਸੀਗੇ ਤੁਸੀਂ ਸਰ ਪੰਜਾਹ ਜਿਆਦੇ ਐ ਆਪਣੇ ਐਂ ਕਰੋ ਤੁਸੀਂ ਘੱਟ ਕਰੋ ਥੋੜੇ ਜਿਹੇ ਅਸੀਂ ਤਾਂ ਵੈਸੇ ਨਾ ਪਹਿਲਾਂ ਤਾਂ ਕਿਸੇ ਢੰਗ ਰੁੱਕਣਾ ਤਾਂ ਸਰ ਥੋਨੂੰ ਪੈਣਾ ਰੁੱਕਣਾ ਸਰ ਥੋਨੂੰ ਪੈਣਾ ਕਿਉਂਕੀ ਫੇਰ ਆਉਂਦੇ ਵੇਲੇ ਸਾਨੂੰ ਕੋਈ ਰਸਤੇ ਚ ਸਾਧਨ ਬਨਨਾ ਈ ਨਈਂ ਥੋਨੂੰ ਸਪੈਸ਼ਲ ਲੈ ਚੱਲੇ ਸਰ ਤੁਸੀਂ ਛੱਡੋ ਯਾਰ ਪੰਜਾਹ ਨੀ ਤੁਸੀਂ ਇਓਂ ਕਰੋ ਵੀਹ ਰੁਪਏ ਸੁਆਰੀ ਲਓ ਤੀਹ ਚੱਲੋ ਮੈਂ ਆਪਣੇ ਨਾਲ ਨਾ ਜਿਹੜੇ ਦੋਸਤਾਂ ਨਾਲ ਮੇਰੇ ਨਾਲ ਜਾ ਰਹੇ ਐ ਮੈਂ ਉਨ੍ਹਾਂ ਨਾਲ ਸਲਾਹ ਕਰਦਾ ਨੰਬਰ ਥੋਡਾ ਮੇਰੇ ਕੋਲ ਆ ਈ ਗਿਆ ਤੇ ਤੁਸੀਂ ਮੰਨ ਲੋ ਤੀਹ ਰੁਪਏ ਕਹਿ ਰਹੇ ਓ ਮੈਂ ਵੀਹ ਰੁਪਏ ਕਹਿ ਰਿਹਾ ਹੈਨਾ ਚੱਲ ਮੈਂ ਉਹਨਾਂ ਨੂੰ ਸਮਝਾਉਂਦਾ ਵੀ ਯਾਰ ਮੇਰੀ ਗੱਲ ਹੋਈ ਆ ਕਿਸੇ ਤੋਂ ਹਾਂ ਪੰਦਰਾਂ ਕ ਮਿੰਟ ਲਾਉਣੇ ਆ ਹੱਦ ਪੰਦਰਾਂ ਮਿੰਟ ਨਈਂ ਓ ਹਾਂ ਅੱਛਾ ਤੁਸੀਂ ਇਓਂ ਕਰੋ ਚੱਲ ਫੇਰ ਵੈਸੇ ਆਪਣਾ ਨਾ ਤੀਹ ਕ ਰੁਪਏ ਚ ਜੱਚ ਜਾਏਗਾ ਮੈਂ ਆਪਣੇ ਦੋਸਤਾਂ ਨਾਲ ਥੋੜੀ ਗੱਲ ਕਰਕੇ ਥੋਨੂੰ ਬੈਕ ਕਾਲ ਕਰਦਾ ਤੀਹ ਕ ਰੁਪਏ ਚ ਹੱਲ ਹੋ ਜਾਏਗਾ ਕਿਉਂਕੀ ਅਸੀਂ ਥੋਨੂੰ ਰੋਕਣਾ ਵੀ ਐ ਨਾ ਓਥੇ ਥੋੜਾ ਟਾਈਮ ਐਦਾਂ ਨਈਂ ਤੇ ਚਲੋ ਆਪਾਂ ਘੱਟ ਕਰ ਲੈਂਦੇ ਚਲੋ ਹੁਣ ਜਿੰਨਾ ਟਾਈਮ ਤੁਸੀਂ ਰੁਕੋਂਗੇ ਚੱਲ ਥੋਨੂੰ ਦਸ ਰੁਪਏ ਐਕਸਟਰਾ ਦੇ ਦਿਆਂਗੇ ਵੈਸੇ ਅਸੀਂ ਵੀਹ ਦੇਣਾ ਚਾਹੁੰਦੇ ਸੀਗੇ ਤੇ ਚਲੋ ਆਪਾਂ ਤੀਹ ਰੁਪਈਆਂ ਦੇ ਵਿੱਚ ਡੰਨ ਐ ਫੇਰ ਠੀਕ ਐ ਮੈਂ ਥੋਨੂੰ ਕੌਲ ਕਰਦਾ ਥੋੜੇ ਟਾਈਮ ਤੱਕ ਠੀਕ ਐ ਜੀ ਓਕੇ